ਹੈਲੋ ਤੁਸੀਂ ਔਲਾ ਟਰਾਂਸਪੋਰਟ ਕੰਪਨੀ ਤੋਂ ਗੱਲ ਕਰਦੇ ਪਏ ਹੋ ਮੈਂ ਤੁਹਾਡੀ ਕੰਪਨੀ ਦੇ ਵਿੱਚ ਕਾਰ ਬੁੱਕ ਕਰਵਾਈ ਸੀ ਅਸੀਂ ਮੈਂ ਅਤੇ ਮੇਰੇ ਸਾਰੇ ਰਿਸ਼ਤੇਦਾਰਾਂ ਨੇ ਅੰਮ੍ਰਿਸ ਤ ਅੰਮ੍ਰਿਤਸਰ ਤੋਂ ਸ਼ਿਮਲਾ ਘੁੰਮਣ ਜਾਣਾ ਸੀ ਅਤੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਕੰਪਲੇਂਨ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਤੁਸੀਂ ਮੇਰੇ ਲਈ ਕਾਰ ਭੇਜੀ ਹੈ ਉਸ ਦੀ ਹਾਲਤ ਬਿਲਕੁਲ ਸਹੀ ਨਹੀਂ ਹੈ ਤੁਹਾਡਾ ਡਰਾਈਵਰ ਟਾਈਮ ਨਾਲ ਪਹੁੰਚ ਤਾਂ ਗਿਆ ਹੈ ਪਰ ਉਸਦੀ ਹਾਲਤ ਬਹੁਤ ਹੀ ਖਰਾਬ ਹੈ ਉਸਦੀਆਂ ਜਿਹੜੀਆਂ ਸੀਟਾਂ ਏ ਉਹ ਬਹੁਤ ਫਟੀਆਂ ਹਨ ਅਤੇ ਉਸਦੀ ਕੰਡੀਸ਼ਨ ਵੀ ਬਹੁਤ ਹੀ ਜ਼ਿਆਦਾ ਖਰਾਬ ਹੋਈ ਆ ਜੇ ਮੈਂ ਅਤੇ ਮੇਰੇ ਰਿਸ਼ਤੇਦਾਰਾਂ ਨੂੰ ਬਹੁਤ ਖੁਸ਼ੀ ਸੀ ਕਿ ਅਸੀਂ ਘੁੰਮਣ ਜਾਣਾ ਹੈ ਅਸੀਂ ਤਾਂ ਸਾਰਿਆਂ ਨੇ ਮਿਲ ਕੇ ਟ੍ਰਿੱਪ ਦਾ ਪਲੈਨ ਕੀਤਾ ਸੀ ਪਰ ਜੇ ਮੈਂ ਹੁਣ ਇਸ ਗੱਡੀ ਦੀ ਹਾਲਤ ਦੇਖਦੀ ਹਾਂ ਅਤੇ ਇਹ ਸੋਚਦੀ ਹਾਂ ਕਿ ਜੇ ਰਸਤੇ ਵਿੱਚ ਇਹ ਪੈਂਚਰ ਹੋ ਗਈ ਤਾਂ ਫੇਰ ਅਸੀਂ ਸਾਰੇ ਕੀ ਕਰਾਂਗੇ ਸਾਡੇ ਸਾਰੇ ਰਿਸ਼ਤੇਦਾਰ ਵੀ ਨਰਾਜ਼ ਹੋ ਜਾਣਗੇ ਅਤੇ ਮੈਂ ਡਰਾਈਵਰ ਨੂੰ ਵੀ ਬਹੁਤ ਨ ਨਿਰਾਸ਼ਾ ਦਿਖਾਈ ਹੈ ਕਿ ਇਹ ਇਹ ਗੱਡੀ ਕਿਸ ਤਰ੍ਹਾਂ ਦੀ ਲੈ ਕੇ ਆਏ ਹੋ ਮੈਂ ਤੁਹਾਨੂੰ ਇਹ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਪਲੀਜ਼ ਨਵੀਂ ਗੱਡੀ ਭੇਜ ਦਿਉ